ਮੈਂ ਫੋਟੋਗ੍ਰਾਫੀ ਇੱਕ ਫੋਟੋ ਸਟੂਡੀਓ 'ਤੇ ਲੱਗ ਕੇ ਸਿੱਖੀ ਹੈ ਜਿੱਥੇ ਮੈਕਸੀਮਮ ਮੈਨੂੰ ਤਿੰਨ ਸਾਲ ਲੱਗੇ ਹਨ ਅਤੇ ਕੁਛ ਚੀਜ਼ਾਂ ਜੋ ਮੈਂ ਇੰਟਰਨੈਟ 'ਤੇ ਵੀ ਸਿੱਖੀਆ ਹਨ ਜਿਵੇਂ ਜਿਵੇਂ ਟਾਈਮ ਡਿਵੈਲਪ ਹੋ ਰਿਹਾ ਉਵੇਂ ਉਵੇਂ ਹੀ ਕੈਮਰੇ ਵੀ ਡਿਵੈਲਪ ਹੋ ਰਹੇ ਹਨ ਅਤੇ ਫੋਟੋਗ੍ਰਾਫੀ ਵੀ ਡਿਵੈਲਪ ਹੋ ਰਹੀ ਹੈ ਸਾਨੂੰ ਟਾਈਮ ਦੇ ਨਾਲ਼ ਡਿਵੈਲਪ ਹੋਣਾ ਪੈਂਦਾ ਹੈ ਅਤੇ ਜੋ ਪੁਰਾਣੇ ਸਮੇਂ ਵਿੱਚ ਫੋਟੋਗ੍ਰਾਫੀ ਕਰਦੇ ਸੀ ਉਹ ਹੋਰ ਚੀਜ਼ਾਂ ਸੀ ਜੋ ਅੱਜ ਕੱਲ੍ਹ ਕਰਦੇ ਹੈ ਉਹ ਨਵੀਆਂ ਚੀਜ਼ਾਂ ਨੇ ਅਤੇ ਅਸੀਂ ਇਹਦੇ ਨਾਲ਼ ਬਹੁਤ ਜ਼ਿਆਦਾ ਪੈਸੇ ਵੀ ਕਮਾ ਸਕਦੇ ਹਾਂ ਅਸੀਂ ਲੋਕਾਂ ਵਿੱਚ ਆਪਣਾ ਨਾਮ ਵੀ ਬਣਾ ਸਕਦੇ ਹਾਂ